ਮੈਂ ਇੱਕ ਕਿਤਾਬ ਪੜ੍ਹੀ ਸੀ ਜਿਹਨੇ ਮੈਨੂੰ ਬੜਾ ਹੀ ਭਾਵੁਕ ਕੀਤਾ ਉਹ ਕਿਤਾਬ ਵਿੱਚ ਇੱਕ ਕਹਾਣੀ ਸੀ ਨੀਲੀ ਉਹ ਨੀਲੀ ਇੱਕ ਗਾਂ ਦੀ ਕਹਾਣੀ ਸੀਗੀ ਉਸ ਕਹਾਣੀ ਵਿੱਚ ਇੱਕ ਗਾਂ ਦੇ ਮਨੋਭਾਵਾਂ ਨੂੰ ਦਰਸਾਇਆ ਹੁੰਦਾ ਵਾ ਕਿ ਜਿਹੜਾ ਕਹਾਣੀਕਾਰ ਹੁੰਦਾ ਵਾ ਉਹ ਬਹੁਤ ਸਾਰੀ ਗਾਵਾਂ ਵਿੱਚੋਂ ਨਾ ਉਹ ਗਾਂ ਪਸੰਦ ਕਰਕੇ ਲੈ ਕੇ ਆਉਂਦਾ ਵਾ ਫਿਰ ਬਾਅਦ ਚੋਂ ਉਹ ਗਾਂ ਨੂੰ ਘਰ ਲਿਆਉਂਦਾ ਆ ਅਤੇ ਉਹਨਾਂ ਨੇ ਗਵਾਲਾ ਰੱਖਿਆ ਹੁੰਦਾ ਵਾ ਉਹਦੇ ਨਾਲ ਨਾ ਗਾਂ ਨੂੰ ਮਤਲਬ ਚੋਕਰ ਪੱਠੇ ਵਧੀਆ ਚਾਰਾ ਖਵਾਉਣ ਵਾਲਾ ਵਧੀਆ ਚਾਰਾ ਖਵਾਉਣ ਦੀ ਨਾ ਸ਼ਰਤ ਤੈਅ ਹੋਈ ਸੀਗੀ ਦੋਵਾਂ ਦੀ ਫਿਰ ਬ ਜਿਹੜਾ ਗਵਾਲਾ ਸੀਗਾ ਉਹ ਇੱਦਾਂ ਹੀ ਕਰਦਾ ਰਿਹਾ ਗਾਂ ਨੂੰ ਉਹ ਵਧੀਆ ਚਾਰਾ ਚੂਰਾ ਖਵਾਉਂਦਾ ਰਿਹਾ ਜਿਹੜੀ ਗਾਂ ਸੀ ਵੀ ਬੜਾ ਹੀ ਚੰਗਾ ਦੁੱਧ ਦਿੰਦੀ ਸੀਗੀ ਫਿਰ ਇੱਦਾਂ ਹੀ ਕੁਝ ਮਹੀਨਿਆਂ ਬਾਅਦ ਨਾ ਗਾਂ ਨਵੇਂ ਦੁੱਧ ਹੋਣ ਵਾਲੀ ਸੀਗੀ ਉਹਨੇ ਫਿਰ ਦੁੱਧ ਦੇਣਾ ਬੰਦ ਕਰਤਾ ਫਿਰ ਕੁਝ ਕੁ ਦਿਨਾਂ ਬਾਅਦ ਫਿਰ ਉਹ ਉਹਦੀ ਸੁੰਦਰ ਵੱਛੀ ਨੇ ਉਹਨੇ ਗਾਂ ਨੇ ਸੁੰਦਰ ਵੱਛੀ ਨੂੰ ਜਨਮ ਦਿੱਤਾ ਫਿਰ ਬਾਅਦ ਚੋਂ ਗਾਂ ਫਿਰ ਦੁੱਧ ਦੇਣਾ ਉਹਨੇ ਸ਼ੁਰੂ ਕਰਤਾ ਅਤੇ ਦੁੱਧ ਬੜਾ ਦਿੰਦੀ ਸੀ ਗਾਂ ਉਹ ਡੇਅਰੀ ਤੇ ਵੀ ਪਾਉਂਦੇ ਹੁੰਦੇ ਸੀਗੇ ਅਤੇ ਘਰੋ ਘਰ ਵੀ ਦਿੰਦੇ ਹੁੰਦੇ ਸੀਗੇ ਗਾਂ ਦਾ ਦੁੱਧ ਫਿਰ ਬਾਅਦ ਵਿੱਚ ਜਿਹੜਾ ਗਵਾਲਾ ਸੀਗਾ ਉਹ ਵੀ ਆਪਣੀ ਪੂਰਾ ਕੰਮ ਇਮਾਨਦਾਰੀ ਨਾਲ ਕਰਦਾ ਰਿਹਾ ਫਿਰ ਹੌਲੀ ਹੌਲੀ ਕੁਝ ਚਿਰ ਬਾਅਦ ਜਿਹੜਾ ਗਵਾਲਾ ਸੀਗਾ ਉਹਨੇ ਵੱਛੀ ਜੋਗਾ ਦੁੱਧ ਛੱਡਣਾ ਬੰਦ ਕਰਤਾ ਅਤੇ ਨਾ ਹੀ ਉਹ ਗਾਂ ਨੂੰ ਚਾਰਾ ਪਾਉਂਦਾ ਸੀਗਾ ਫਿਰ ਮਤਲਬ ਇਕੱਲੇ ਪੱਠੇ ਪਾਉਂਦਾ ਸੀਗਾ ਫੁੱਲ ਬੜੇਵੇਂ ਜੇ ਚੋਕਰ ਪਾਉਣੀ ਆ ਉਹ ਨਹੀਂ ਸੀ ਪਾਉਂਦਾ ਫਿਰ ਬਾਅਦ ਚੋਂ ਜਿਹੜੀ ਵੱਛੀ ਸੀਗੀ ਉਹ ਹੌਲੀ ਹੌਲੀ ਸੁੱਕਦੀ ਗਈ ਬੜੀ ਕਮਜ਼ੋਰ ਜਿਹੀ ਹੁੰਦੀ ਜਾਂਦੀ ਦਿਨੋ ਦਿਨ ਵੱਛੀ ਫਿਰ ਜਿਹੜਾ ਕਹਾਣੀ ਫਿਰ ਬਾਅਦ 'ਚੋਂ ਇੱਕ ਦਿਨ ਜਿਹੜੀ ਵੱਛੀ ਸੀ ਉਹ ਮਰ ਗਈ ਅਤੇ ਵੱਛੀ ਦੇ ਮਰਨ ਨਾਲ ਜਿਹੜੀ ਗਾਂ ਸੀ ਉਹ ਬੜੀ ਦੁੱਖੀ ਹੋਈ ਅਤੇ ਜਿਹੜਾ ਗਵਾਲਾ ਸੀਗਾ ਉਹਨੇ ਗਾਂ ਦਾ ਦੁੱਧ ਚੋਣ ਦੀ ਕੋਸ਼ਿਸ਼ ਕੀਤੀ ਪਰ ਗਾਂ ਨੇ ਲੱਤ ਮਾਰਤੀ ਛੜ ਮਾਰ ਕੇ ਗਾਂ ਜਿਹੜੀ ਉਹ ਪਾਸੇ ਹੋ ਗਈ ਫਿਰ ਬਾਅਦ ਵਿੱਚ ਜਿਹੜੀ ਗਾਂ ਸੀਗੀ ਫਿਰ ਗਵਾਲੇ ਨੇ ਗਾਂ ਨੂੰ ਪੁਚਕਾਰਿਆਂ ਉਹਦੀ ਪਿੱਠ 'ਤੇ ਹੱਥ ਮਾਰਿਆ ਬੜਾ ਪਿਆਰ ਕੀਤਾ ਗਾਂ ਨੂੰ ਪਰ ਗਾਂ ਨੇ ਫਿਰ ਵੀ ਦੁੱਧ ਨਾ ਦਿੱਤਾ ਤਾਂ ਜਿੱਦਾਂ ਫਿਰ ਜਿਹੜਾ ਗਵਾਲਾ ਸੀਗਾ ਉਹਨੇ ਜਿਹੜਾ ਗਵਾਲਾ ਸੀਗਾ ਉਹਨੇ ਫਿਰ ਜਿਹੜੀ ਗਾਂ ਉਹਨੇ ਜੇ ਚਾਰੇ ਵਾਲੀ ਟੋਕਰੀ ਤਿਆਰ ਕੀਤੀ ਅਤੇ ਉਹ ਗਾਂ ਅਗਾੜੀ ਰੱਖੀ ਫਿਰ ਬਾਅਦ ਚੋਂ ਗਾਂ ਨੇ ਨਾ ਪੱਠੇ ਖਾਣੇ ਸ਼ੁਰੂ ਕਰਤੇ ਚੋਕਰ ਚਾਰਾ ਚੂਰਾ ਖਾਣਾ ਸ਼ੁਰੂ ਕਰਤਾ ਫਿਰ ਬਾਅਦ ਵਿੱਚ ਉਹਨੇ ਫਿਰ ਦੁੱਧ ਚੋਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਗਾਂ ਉਹ ਲੱਤ ਮਾਰ ਕੇ ਪਾਸੇ ਹੋ ਗਈ ਫਿਰ ਬਾਅਦ ਵਿੱਚ ਗਵਾਲੇ ਨੂੰ ਗੁੱਸਾ ਆਇਆ ਉਹਨੇ ਜਿਹੜੀ ਚਾਰੇ ਵਾਲੀ ਟੋਕਰੀ ਹੈਗੀ ਉਹ ਚੁੱਕ ਕੇ ਭੱਜ ਗਿਆ ਫਿਰ ਬਾਅਦ ਚੋਂ ਜਿਹੜੀ ਗਾਂ ਸੀਗੀ ਉਹ ਗਵਾਲੇ ਵੱਲ ਵੇਖ ਕੇ ਅੜਿੰਗਦੀ ਰਹੀ ਕਿ ਜਿੱਦਾਂ ਉਹਨੂੰ ਕਹਿੰਦੀ ਪਈ ਹੋਵੇ ਹਾਲੇ ਕੁਝ ਕੁ ਦਿਨ ਹੋਏ ਆ ਉਹਦੀ ਵੱਛੀ ਨੂੰ ਮਰਿਆ ਹਾਲੇ ਉਹ ਉਸ ਦਾ ਗਮ ਭੁਲਾ ਨਹੀਂ ਸਕਦੀ ਇੱਦਾਂ ਹੀ ਇਸ ਕਹਾਣੀ ਨੇ ਮੈਨੂੰ ਬਹੁਤ ਭਾਵੁਕ ਕੀਤਾ ਇਸ ਗਾਂ ਨੇ